ਦਾਦੀ ਜੀ ਦੀ ਮੌਤ ਤੋਂ ਬਾਅਦ ਕੁਝ ਸਮਾਂ ਬੀਤਣ ਦੀ ਮੈਨੂੰ ਚਿੰਤਾ ਹੋਈ ਕਿ ਦਾਦੀ ਜੀ ਦੀ ਮੌਤ ਦਾ ਰਿਕਾਰਡ ਅਧਿਕਾਰਿਕ ਪ੍ਰਣਾਲੀ ਵਿੱਚ ਮੌਜੂਦ ਹੈ ਜਾਂ ਨਹੀਂ ਮੈਂ ਇਹ ਜਾਣਨ ਲਈ ਪਰਿਵਾਰ ਨਾਲ ਗੱਲਬਾਤ ਕਰਕੇ ਆਪਣੇ ਰਿਸ਼ਤੇਦਾਰ ਨੂੰ ਨਾਲ ਲੈ ਕੇ ਰਜਿਸਟਰੇਸ਼ਨ ਦਫਤਰ ਗਿਆ ਅਤੇ ਦਾਦੀ ਜੀ ਦੀ ਮੌਤ ਦੀ ਤਾਰੀਖ ਦੱਸ ਕੇ ਉਹਨਾਂ ਤੋਂ ਰਿਕਾਰਡ ਮੰਗਿਆ ਤਾਂ ਉਹਨਾਂ ਨੇ ਮੈਨੂੰ ਸਾਰਾ ਰਿਕਾਰਡ ਦਿਖਾਇਆ ਅਤੇ ਕਿਹਾ ਕਿ ਤੁਹਾਡੀ ਦਾਦੀ ਜੀ ਦਾ ਰਿਕਾਰਡ ਸਾਡੇ ਕੋਲ ਦਰਜ ਹੈ ਅਤੇ ਅਸੀਂ ਤੁਹਾਨੂੰ ਇਸ ਦਾ ਸਰਟੀਫਿਕੇਟ ਦੇ ਦਿੰਦੇ ਹਾਂ ਜਿਸ ਨਾਲ ਤੁਸੀਂ ਉਹਨਾਂ ਦੀ ਸਾਰੀ ਸੰਪੱਤੀ ਆਪਣੇ ਨਾਂ ਕਰਵਾ ਸਕਦੇ ਹੋ ਅਤੇ ਉਹਨਾਂ ਦੇ ਵਾਰਿਸਨਾਮੇ 'ਤੇ ਆਪਣਾ ਨਾਂ ਲਿਖਵਾ ਸਕਦੇ ਹੋ ਸਾਰਾ ਰਿਕਾਰਡ ਦੇਖ ਕੇ ਅਤੇ ਪਰਿਵਾਰ ਨਾਲ ਇਹ ਸਾਰਾ ਇੱਕ ਵਾਰ ਸਾਂਝਾ ਕਰਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਅਤੇ ਮੈਂ ਇਹ ਸਾਰੀ ਜਾਣਕਾਰੀ ਆਪਣੇ ਵਕੀਲ ਨਾਲ ਸਾਂਝੀ ਕਰਕੇ ਸਾਰੀ ਜ਼ਮੀਨ ਜਾਇਦਾਦ ਆਪਣੇ ਨਾਂ ਕਰਵਾ ਲਈ